ਸਤਿ ਸ਼੍ਰੀ ਅਕਾਲ ਜੀ ਬੇਅੰਤ ਸਿੰਘ ਬੋਲ ਰਹੇ ਹੋ ਅਸੀਂ ਤੁਹਾਡੀ ਕੈਬ ਬੁੱਕ ਕੀਤੀ ਹੈ ਜਿਹਦਾ ਨੰਬਰ ਪੰਜ ਸੌ ਜੀਰੋ ਪੰਜ ਜੀਰੋ ਇੱਕ ਤਿੰਨ ਹੈ ਅਸੀਂ ਮਾਨਸਾ ਤੋਂ ਦਿੱਲੀ ਜਾਣਾ ਹੈ ਅਤੇ ਅਸੀਂ ਕੱਲ੍ਹ ਨੂੰ ਅਸੀਂ ਰੇਲਵੇ ਸਟੇਸ਼ਨ ਤੋਂ ਤੁਹਾਡੀ ਕੈਬ ਬੁੱਕ ਕਰਨੀ ਹੈ ਅਤੇ ਤੁਸੀਂ ਦੱਸ ਸਕਦੇ ਹੋ ਸਾਨੂੰ ਉੱਥੋਂ ਤੱਕ ਜਾਣ ਦਾ ਕਿੰਨਾ ਟਾਈਮ ਲੱਗੂਗਾ ਅਤੇ ਅਸੀਂ ਹਾਂਜੀ